ਸਾਡੇ ਪੰਜਾਬ ਵਿੱਚ ਰੈਸਪੀ ਵਿੱਚ ਬਹੁਤ ਦੁਰਲੱਭ ਅਸਧਾਰਨ ਸਮੱਗਰੀਆਂ ਪਾਈਆਂ ਜਾਂਦੀਆਂ ਹਨ ਫਸਟਲੀ ਆਈ ਟਰਾਏ ਸਾਗ ਫਸਟਲੀ ਸਾਗ ਸਾਗ ਵਿੱਚ ਸਭ ਤੋਂ ਪਹਿਲਾਂ ਮੈਂ ਉਸਨੂੰ ਤੋੜ ਕੇ ਲਿਆਉਂਦਾ ਫਿਰ ਉਸਨੂੰ ਕੱਟਿਆ ਅਤੇ ਉਸ ਵਿੱਚ ਮੇਥੀ ਪਨੀਰ ਮੇਥੀ ਪਾਲਕ ਆਦਿ ਪਾਇਆ ਅਤੇ ਉਸਨੂੰ ਕੱਟਿਆ ਉਸ ਨੂੰ ਕੱਟਿਆ ਅਤੇ ਉਸ ਨੂੰ ਪਤੀਲੇ ਵਿੱਚ ਰੱਖਿਆ ਅਤੇ ਦੋ ਤਿੰਨ ਘੰਟੇ ਉਹ ਉਸ ਵਿੱਚ ਉਬਾਲਿਆ ਗਿਆ ਉਸ ਨੂੰ ਅਤੇ ਉਸ ਵਿੱਚ ਬਾਅਦ ਵਿੱਚ ਉਸਨੂੰ ਘੋਟਿਆ ਗਿਆ ਅਤੇ ਉਸ ਲਈ ਮੈਂ ਸ ਤੜਕਾ ਤਿਆਰ ਕੀਤਾ ਪ ਪਿਆਜ਼ ਪਿਆਜ਼ ਲਸਣ ਅਦਰਕ ਆਦਿ ਨੂੰ ਕੱਟ ਕੇ ਗਰਾਇੰਡ ਕਰਕੇ ਉਸ ਵਿੱਚ ਤੇਲ ਪਾ ਕੇ ਤੜਕਾ ਲਗਾਇਆ ਅਤੇ ਫਿਰ ਉਸ ਸਾਗ ਨੂੰ ਉਸ ਵਿੱਚ ਪਾਇਆ ਅਤੇ ਜਿਸ ਨਾਲ ਮੇਰੀ ਸਾਗ ਦੀ ਰੈਸਿਪੀ ਤਿਆਰ ਹੋ ਚੁੱਕੀ ਸੀ ਸੈਕਿੰਡ ਆਈ ਟਰਾਏ ਮੈਂ ਟਰ ਦ ਟਰਾਈ ਕੀਤਾ ਦਾਲ ਅਤੇ ਫਸਟਲੀ ਆਈ ਮੈਂ ਮੈਂ ਦਾਲ ਵੀ ਦਾਲ ਨੂੰ ਕੁੱਕਰ ਵਿੱਚ ਰੱਖਿਆ ਪਾਣੀ ਪਾਇਆ ਥੋੜ੍ਹਾ ਜਿਹਾ ਕੁੱਕਰ ਵਿੱਚ ਦਾਲ ਪਾਈ ਅਤੇ ਉਸਨੂੰ ਗੈਸ ਉੱਤੇ ਰੱਖਿਆ ਅਤੇ ਫਿਰ ਉਸ ਲਈ ਮੈਂ ਤੜਕਾ ਤਿਆਰ ਕੀਤਾ ਪਿਆਜ਼ ਅਦਰਕ ਆਦਿ ਨੂੰ ਕੱਟ ਕੇ ਗਰਾਇੰਡ ਕੀਤਾ ਅਤੇ ਫਿਰ ਉਸਨੂੰ ਤੜਕਾ ਤੜਕਾ ਲਗਾਇਆ ਤੜਕਾ ਲਗਾਇਆ ਅਤੇ ਕੁੱਕਰ ਵਿੱਚੋਂ ਦਾਲ ਨੂੰ ਕੱਢ ਕੇ ਤੜਕੇ ਵਿੱਚ ਪਾਇਆ ਅਤੇ ਜਿਸ ਨਾਲ ਮੇਰੀ ਰੈਸਪੀ ਦਾਲ ਤਿਆਰ ਹੋ ਚੁੱਕੀ ਸੀ ਥਰਡ ਮੈਂ ਮਟਰ ਪਨੀਰ ਤਿਆਰ ਕੀਤਾ ਪਹਿਲਾਂ ਅਸੀਂ ਪਨੀਰ ਪਹਿਲਾਂ ਅਸੀਂ ਮੱਝ ਦੇ ਦੁੱਧ ਤੋਂ ਪਨੀਰ ਬਣਾਇਆ ਅਤੇ ਉਸ ਫਿਰ ਫਿਰ ਮਟਰ ਨੂੰ ਕੱਢ ਕੇ ਫਿਰ ਪਨੀਰ ਨੂੰ ਕੱਟ ਕੇ ਕੱਟ ਕੇ ਪਿਆਜ਼ ਅਦਰਕ ਆਦਿ ਨੂੰ ਗਰਾਇੰਡ ਕੀਤਾ ਅਤੇ ਫਿਰ ਉਸ ਵਿੱਚ ਮੈਂ ਉਸਨੂੰ ਤੜਕਾ ਲਗਾਇਆ ਅਤੇ ਫਿਰ ਮਟਰ ਪਨੀਰ ਨੂੰ ਉਸ ਵਿੱਚ ਪਾ ਦਿੱਤਾ ਅਤੇ ਉਸਨੂੰ ਕੁੱਕਰ ਵਿੱਚ ਪਾ ਕੇ ਅ ਰੱਖ ਦਿੱਤਾ ਅਤੇ ਜਿਸ ਨਾਲ ਉਹ ਦੋ ਤਿੰਨ ਸੀਟੀਆਂ ਵਿੱਚ ਮੇਰੀ ਮਟਰ ਪਨੀਰ ਰੈਸਿਪੀ ਤਿਆਰ ਹੋ ਚੁੱਕੀ ਸੀ ਸੋ ਮੈਂ ਆਹ ਆਹ ਤਿੰਨ ਟਰਾਏ ਕੀਤੀਆਂ ਸੀ